ਪੰਜਾਬੀ ਭਾਸ਼ਾ ਦੇ ਬਾਰੇ ਜੇ ਗੱਲ ਕੀਤੀ ਜਾਏ ਤਾਂ ਬੱਚਿਆਂ ਨੂੰ ਜਿਹੜੀ ਪੰਜਾਬੀ ਭਾਸ਼ਾ ਸਿਖਾਉਣੀ ਬੜੀ ਮਹੱਤਵਪੂਰਨ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਜਿਹੜੀ ਭਾਸ਼ਾ ਦੇ ਵਰਨ ਜਿਹੜੇ ਹੈਗੇ ਆ ਅੱਖਰ ਜਿਹੜੇ ਨੇ ਪੈਂਤੀ ਅੱਖਰ ਹੈ ਜਿਹੜੇ ਕਿ ਬਹੁਤ ਵਡਮੁੱਲਾ ਖਜ਼ਾਨਾ ਆ ਅਤੇ ਦੂਸਰੀ ਕੀ ਪੰਜਾਬ ਦੇ ਇੱਕ ਜਿਹੜੀ ਹੈ ਮਾਤਰ ਭਾਸ਼ਾ ਪੰਜਾਬੀ ਹੈ ਇਸ ਲਈ ਮਾਤਰ ਭਾਸ਼ ਜਿਹੜੀ ਮਾਤਰ ਭਾਸ਼ਾ ਬੱਚਿਆਂ ਨੂੰ ਸਿਖਾਉਣੀ ਆ ਅਤੇ ਬਹੁਤ ਹੀ ਮਹੱਤਵਪੂਰਨ ਕਿਉਂਕਿ ਇਸ ਤੋਂ ਬਿਨਾਂ ਤਾਂ ਕੁਛ ਵੀ ਬੱਚਾ ਸਿੱਖ ਨਹੀਂ ਸਕਦਾ ਕਿਉਂਕਿ ਇਹਦਾ ਪੰਜਾਬ ਦਾ ਵਿਰਸਾ ਬਹੁਤ ਵੱਡਾ ਇਹ ਵਿਰਸੇ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦਾ ਗਿਆਨ ਬਹੁਤ ਜ਼ਰੂਰੀ ਹੈ ਇਸ ਲਈ ਸਿੱਖਣੀ ਇਹ ਜਿਹੜੀ ਭਾਸ਼ਾ ਅਸੀਂ ਬਹੁਤ ਜ਼ਰੂਰੀ ਸਮਝਦੇ ਹਾਂ